ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਹ ਸਭ ਤੋਂ ਮੇਨ ਪ੍ਰੌਬਲਮ ਪੜ੍ਹਾਈ ਦੇ ਵਿੱਚ ਆਈ ਮੇਰੇ ਪਿਤਾ ਜੀ ਆਰਥਿਕ ਤੌਰ 'ਤੇ ਇੰਨੇ ਮਜ਼ਬੂਤ ਨਹੀਂ ਸਨ ਕਿ ਸਾਡੀ ਸਾਰਾ ਪਰਿਵਾਰ ਹੁੰਦੇ ਹੋਏ ਮੇਰੀ ਪੜ੍ਹਾਈ ਦਾ ਖਰਚਾ ਚੱਕ ਸਕਣ ਪਰ ਫ਼ਿਰ ਵੀ ਉਹਨਾਂ ਨੇ ਮੈਨੂੰ ਮਨ੍ਹਾਂ ਨਹੀਂ ਕੀਤਾ ਫਿਰ ਵੀ ਉਹਨਾਂ ਨੇ ਮੈਨੂੰ ਪੜ੍ਹਾਇਆ ਅਤੇ ਮੇਰੇ ਮਾਤਾ ਜੀ ਨੇ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਅਤੇ ਉਹਨਾਂ ਦੀ ਸਪੋਰਟ ਨਾਲ ਹੀ ਮੈਂ ਆਪਣੀ ਪੜ੍ਹਾਈ ਪੂਰੀ ਕਰ ਪਾਈ ਹਾਂ ਅਤੇ ਮੈਂ ਵੀ ਫ਼ਿਰ ਉਹਨਾਂ ਦੇ ਸਪੋਰਟ ਦੇ ਲਈ ਦਿਨ ਰਾਤ ਇੱਕ ਕਰ ਦਿੱਤੀ ਅਤੇ ਪੂਰੀ ਰੱਜ ਕੇ ਮਿਹਨਤ ਕੀਤੀ ਅਤੇ ਆਪਣੀ ਪੜ੍ਹਾਈ ਦੇ ਵਿੱਚ ਵਧੀਆ ਅੰਕ ਲੈਕੇ ਉਹਨਾਂ ਦਾ ਨਾਮ ਰੋਸ਼ਨ ਕੀਤਾ